ਨਮਸਕਾਰ ਜੀ ਮੇਰਾ ਨਾਮ ਸ਼ਸ਼ੀ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੈਂ ਬਸ ਦਾ ਸਫਰ ਕੀਤਾ ਮੈਂ ਹਿਮਾਚਲ ਵਾਲੀ ਸਾਈਡ ਵੱਲ ਗਈ ਅਤੇ ਸਾਨੂੰ ਮਤਲਬ ਕਿ ਜਿਹੜੀ ਆਪਣੇ ਡਰਾਈਵਰ ਵਾਲੀ ਸੀਟ ਦੇ ਲਾਗੇ ਬਹਿਣਾ ਅਤੇ ਬਹਿਨਾ ਅੱਛਾ ਨਹੀਂ ਲੱਗਿਆ ਕਿਉਂਕਿ ਉਹਦੇ ਜਦੋਂ ਜਦੋਂ ਉਹਦੇ ਇੰਜਣ ਦਾ ਸੇਕ ਹੁੰਦਾ ਉਹ ਸਾਨੂੰ ਪੈਂਦਾ ਇਸ ਕਰਕੇ ਮੈਨੂੰ ਉੱਥੇ ਬਹਿਣਾ ਨਹੀਂ ਪਸੰਦ ਕੀਤਾ ਤਾਂ ਅਸੀਂ ਆਪਣੀ ਵਿੰਡੋ ਵਾਲੀ ਸੀਟ 'ਤੇ ਹੀ ਬੈਠੇ ਅਤੇ ਆਪਣੀ ਫੈਮਲੀ ਨਾਲ ਗਏ ਉੱਥੇ ਵਿੰਡੋ ਦੇ ਵਿੱਚ ਇਹ ਵਾਧਾ ਆ ਵੀ ਅਸੀਂ ਆਪਣੇ ਬਾਹਰ ਦੀ ਲੋਕੇਸ਼ਨ ਸਾਰੀ ਦੇਖ ਸਕਦੇ ਹਾਂ ਅਸੀਂ ਜਦੋਂ ਹਿਮਾਚਲ ਸਾਇਡ 'ਤੇ ਗਏ ਪਹਾੜਾਂ ਦੀ ਲੁੱਕ ਬਹੁਤ ਅੱਛੀ ਲੱਗੀ ਸਾਨੂੰ ਅੱਗੇ ਅੱਗੇ ਜਾਂਦੇ ਹੋਏ ਆ ਸਾਨੂੰ ਬਰਖਾ ਮਤਲਬ ਕਿ ਵਰਖਾ ਪੈ ਰਹੀ ਸੀ ਅਤੇ ਉਹ ਵਿਊ ਬਹੁਤ ਅੱਛਾ ਸੀ ਪਹਾੜਾਂ ਵਾਲਾ ਅਤੇ ਵਿੰਡੋ ਦੇ ਵਿੱਚ ਜਿਹੜਾ ਬੈਠਣਾ ਉਹਦੇ ਵਿੱਚ ਫਰੈਸ਼ ਹਵਾ ਆਉਣੀ ਉਹ ਇੱਕ ਅਲੱਗ ਹੀ ਮਜ਼ਾ ਦਿੰਦੀ ਆ ਅਤੇ ਹੋਰ ਤੁਸੀਂ ਦੇਖੋ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੰਨੀ ਕ ਟਰੈਫਿਕ ਹੈਗੀ ਆ ਅਤੇ ਉਹਦੇ ਬੱਸਾਂ 'ਚ ਵੀ ਕਾਫੀ ਧੱਕਾ ਮੁੱਕੀ ਹੁੰਦੀ ਰਹਿੰਦੀ ਆ ਅਤੇ ਇਹਦੇ ਵਾਸਤੇ ਸਾਨੂੰ ਸੁਰੱਕਸ਼ਿਤ ਹੋਣ ਵਾਸਤੇ ਸਾਨੂੰ ਇੱਕ ਬੱਸ ਦੇ ਵਿੱਚ ਵਿੰਡੋ ਵਾਲੀ ਸੀਟ 'ਤੇ ਹੀ ਬਹਿਣਾ ਚਾਹੀਦਾ ਕਿਉਂਕਿ ਜਦੋਂ ਡਰਾਈਵਰ ਇੱਕਦਮ ਬਰੇਕ ਜਦੋਂ ਅਸੀਂ ਕਈ ਵਾਰੀ ਸਾਨੂੰ ਸੀਟ ਨਹੀਂ ਮਿਲਦੀ ਤਾਂ ਅਸੀਂ ਖੜ੍ਹੇ ਹੋ ਕੇ ਜਾਂਦੇ ਹਾਂ ਅਤੇ ਅਚਾਨਕ ਡਰਾਈਵਰ ਜਦੋਂ ਸੀਟ 'ਤੇ ਮਤਲਬ ਬਰੇਕ ਲਗਾਉਂਦਾ ਆਪਣੀ ਬੱਸ ਨੂੰ ਅਤੇ ਉਹਦੇ ਨਾਲ ਸਾਡਾ ਐਕਸੀਡੈਂਟ ਹੋਣ ਦਾ ਵੀ ਡਰ ਹੁੰਦਾ ਅਸੀਂ ਇੱਕ ਦੂਜੇ ਦੇ ਉੱਤੇ ਡਿੱਗਣੇ ਹਾਂ ਇਸ ਕਰਕੇ ਜਦੋਂ ਵੀ ਸਫਰ ਕਰੋ ਆਪਣਾ ਚੰਗਾ ਬਣਾਉਣ ਵਾਸਤੇ ਸਫਰ ਨੂੰ ਸਾਨੂੰ ਆਪਣੇ ਯਾਤਰਾ ਨੂੰ ਸਫਲ ਬਣਾਉਣ ਵਾਸਤੇ ਸਾਨੂੰ ਉਹਦੇ ਬੱਸ ਵਿੱਚ ਆਪਣੀ ਵਿੰਡੋ ਵਾਲੀ ਸੀਟਾਂ 'ਤੇ ਹੀ ਬਹਿਣਾ ਚਾਹੀਦਾ ਕਿ ਜਿਸ 'ਚ ਅਸੀਂ ਪ੍ਰੋਪਰ ਆਰਾਮ ਨਾਲ ਜਾ ਸਕੀਏ ਅਤੇ ਇਹੀ ਜੇ ਅਸੀਂ ਖੜ੍ਹੇ ਹੋ ਕੇ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਸਾਨੂੰ ਸੱਟ ਲੱਗਣ ਦਾ ਵੀ ਡਰ ਹੁੰਦਾ ਅਤੇ ਜਦੇ ਲੰਬੇ ਸਫਰ ਵਿੱਚ ਸਾਨੂੰ ਉਹਦੇ ਵਿੱਚ ਬੱਸ ਵਿੱਚ ਵੀ ਬੁਕਿੰਗ ਕਰਾ ਕੇ ਹੀ ਜਾਣਾ ਚਾਹੀਦਾ ਜਿਹਦੇ ਨਾਲ ਵੀ ਸਾਡਾ ਸਫਰ ਸੁੱਖ ਦਾ ਹੋਏ ਅਤੇ ਔਰ ਅਸੀਂ ਆਰਾਮ ਨਾਲ ਆਪਣੀ ਸ ਸਫਰ ਨੂੰ ਕਰ ਸਕੀਏ ਧੰਨਵਾਦ